ਹਾਂਜੀ ਮੈਂ ਓਸ਼ੋ ਇੱਕ ਇੱਦਾਂ ਦੀ ਬੁੱਕ ਹੈ ਜਿਹਦੇ ਵਿੱਚ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਮੀਨਜ਼ ਉਹ ਤੁਹਾਡੇ ਦਿਮਾਗ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੰਦੀ ਹੈ ਠੀਕ ਹੈ ਇੱਦਾਂ ਲੱਗਦਾ ਕਿ ਜਿਵੇਂ ਜਿਵੇਂ ਤੁਸੀਂ ਉਹਨੂੰ ਪੜ੍ਹੀ ਜਾਂਦੇ ਹੋ ਠੀਕ ਹੈ ਓਸ਼ੋ ਨੇ ਗੁਰੂ ਨਾਨਕ ਦੇਵ ਜੀ ਬਾਰੇ ਹੋਰ ਜੋ ਵੀ ਜਿੰਨਾ ਵੀ ਕੁਝ ਲਿਖਿਆ ਹੋਇਆ ਠੀਕ ਹੈ ਮੀਨਜ਼ ਇੰਨਾ ਇਫੈਕਟਿਵ ਲਿਖਿਆ ਵੀ ਜਿੱਦਾਂ ਜਿੱਦਾਂ ਪੜ੍ਹਦੇ ਹਾਂ ਇੱਦਾ ਲੱਗਦਾ ਵੀ ਤੁਹਾਡਾ ਦਿਮਾਗ ਵੀ ਚੇਂਜ ਹੋ ਰਿਹਾ ਹੈ ਠੀਕ ਹੈ ਇੱਦਾਂ ਲੱਗਦਾ ਵੀ ਤੁਸੀਂ ਜਿਹੜਾ ਕੁਝ ਸੋਚਦੇ ਹੋ ਠੀਕ ਹੈ ਉਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਵੱਖ ਕਰਤੀ ਠੀਕ ਹੈ ਬਿਲਕੁਲ ਮੀਨਜ਼ ਸੋਚ ਚੇਂਜ ਹੋਣ ਲੱਗ ਜਾਂਦੀ ਹੈ ਬੰਦੇ ਦੀ ਠੀਕ ਹੈ ਉਹ ਕੀ ਸੋਚਦਾ ਠੀਕ ਹੈ ਉਹਨੂੰ ਇੱਦਾਂ ਲੱਗਦਾ ਵੀ ਉਹਦਾ ਇਨਵਾਇਰਮੈਂਟ ਵੀ ਚੇਂਜ ਹੋ ਗਿਆ ਠੀਕ ਹੈ ਉਹਦੇ ਆਸੇ ਪਾਸੇ ਉਹਦਾ ਲੋਕਾਂ ਨਾਲ ਜਿਹੜਾ ਵਰਤਾਓ ਹੈ ਉਹ ਵੀ ਚੇਂਜ ਹੋ ਜਾਂਦਾ ਠੀਕ ਹੈ ਉਹਦੀ ਵਰਡਿੰਗ ਹੀ ਇਦਾਂ ਦੀ ਹੈ ਵੀ ਉਹ ਤੁਹਾਡੇ ਦਿਮਾਗ 'ਚ ਘਰ ਕਰ ਜਾਂਦੀ ਹੈ ਠੀਕ ਹੈ ਮੀਨਜ਼ ਤੁਸੀਂ ਉਹਦੇ ਵਰਡਿੰਗ ਨਾਲ ਇੱਦਾਂ ਸਮਝਦੇ ਹੋ ਤੁਸੀਂ ਵੀ ਤੁਹਾਨੂੰ ਐਂ ਲੱਗੇਗਾ ਵੀ ਹਾਂ ਯਾਰ ਇਹ ਵਾਕਈ ਸਹੀ ਗੱਲ ਹੈ ਵੀ ਕੁਝ ਨਹੀਂ ਹੈਗਾ ਇਨ੍ਹਾਂ ਚੀਜ਼ਾਂ ਵਿੱਚ ਠੀਕ ਹੈ ਮੀਨਜ਼ ਕਈ ਗੱਲਾਂ ਇੱਦਾਂ ਦੀਆਂ ਜਿਹੜੀਆਂ ਦਿੱਖਦੀਆਂ ਬਹੁਤ ਜ਼ਿਆਦਾ ਅਤੇ ਹੁੰਦਾ ਕੁਝ ਵੀ ਨਹੀਂ ਹੈਗਾ ਠੀਕ ਹੈ ਅਤੇ ਆਪਾਂ ਮੀਨਜ਼ ਉਹਨੂੰ ਇੰਨਾ ਸੀਰੀਜ਼ ਲੈ ਜਾਂਦੇ ਆ ਵੀ ਨਹੀਂ ਯਾਰ ਇੱਦਾਂ ਹੋ ਐਂ ਇਹ ਹੋ ਗਿਆ ਪਰ ਨਹੀਂ ਇੱਦਾਂ ਕੁਝ ਨਹੀਂ ਹੈਗਾ ਠੀਕ ਹੈ ਉਹਨੇ ਇੰਨਾਂ ਸਰਲਤਾ ਨਾਲ ਤੁਹਾਨੂੰ ਉਸ ਬੁੱਕ ਦੇ ਵਿੱਚ ਐਕਸਪਲੇਨ ਕੀਤਾ ਹੋਇਆ ਕਿ ਤੁਸੀਂ ਉਹ ਪੜ੍ਹ ਕੇ ਬਿਲਕੁਲ ਚੇਂਜ ਹੋ ਜਾਓਂਗੇ ਠੀਕ ਹੈ ਤੁਹਾਨੂੰ ਇੱਦਾਂ ਹੀ ਲੱਗੂਗਾ ਵੀ ਵਾਕਈ ਯਾਰ ਜ਼ਿੰਦਗੀ ਦੇ ਵਿੱਚ ਜਿਉਣਾ ਹੀ ਇਹ ਹੈ ਠੀਕ ਹੈ ਵੀ ਮੀਨਜ਼ ਜਿਉਂ ਹੀ ਤੁਸੀਂ ਆਏਂ ਸਕਦੇ ਹੋ ਠੀਕ ਹੈ ਜਿਓਣ ਲਈ ਠੀਕ ਹੈ ਉਹ ਜਿਵੇਂ ਜਿਵੇਂ ਮੀਨਜ਼ ਤੁਸੀਂ ਪੜ੍ਹੋਗੇ ਤੁਹਾਡੇ ਦਿਮਾਗ ਨੂੰ ਠੀਕ ਹੈ ਇੱਦਾਂ ਚੇਂਜ ਕਰੀ ਜਾਊਗੀ ਵੀ ਵੀ ਪਤਾ ਹੀ ਨਹੀਂ ਲੱਗੇਗਾ ਵੀ ਯਾਰ ਹਾਂ ਯਾਰ ਮੈਂ ਆਹ ਗੱਲਾਂ ਦੀ ਐਂਵੀ ਸੋਚੀ ਜਾਂਦਾ ਸੀ ਵੀ ਇਹ ਕੋਈ ਗੱਲਾਂ ਕਿਤੇ ਇਹ ਸੋਚਣ ਵਾਲਿਆਂ ਠੀਕ ਹੈ ਤੁਹਾਨੂੰ ਇੰਨਾਂ ਕੁ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਠੀਕ ਹੈ ਵੀ ਕਿਸੇ ਦੇ ਬਾਹਰ ਵਾਲੀਆਂ ਗੱਲਾਂ ਵੀ ਤੁਹਾਡੇ ਉੱਤੇ ਕੋਈ ਇਫੈਕਟ ਨਹੀਂ ਪੈਂਦਾ ਠੀਕ ਹੈ ਨਾ ਹੀ ਉਹਨਾਂ ਦਾ ਗੱਲਾਂ ਦਾ ਕੋਈ ਤੁਹਾਡੇ 'ਤੇ ਅਸਰ ਹੁੰਦਾ ਠੀਕ ਹੈ ਤੁਸੀਂ ਜਿਹੜਾ ਪਹਿਲਾਂ ਕੁਝ ਸੋਚਦੇ ਸੀ ਪਹਿਲਾਂ ਐਦਾਂ ਕਰਦੇ ਸੀ ਉਹ ਚੀਜ਼ਾਂ ਸਭ ਖ਼ਤਮ ਹੋ ਜਾਂਦੀਆਂ ਠੀਕ ਹੈ ਤੁਹਾਡੀ ਬਹੁਤ ਚੀਜ਼ ਜਿਹੜੀ ਪੌਜ਼ੀਟਿਵ ਹੋ ਜਾਂਦੀ ਹੈ ਠੀਕ ਹੈ ਮੀਨਜ਼ ਉਹ ਕ ਇੰਨੀ ਜ਼ਿਆਦਾ ਵਧੀਆ ਤੁਸੀਂ ਸੋਚ ਵੀ ਨਹੀਂ ਸਕਦੇ ਇੰਨੀ ਇਫ਼ੈਕਟਿਵ ਹੈ ਤੁਹਾਨੂੰ ਇੰਨੀ ਕੁ ਜ਼ਿਆਦਾ ਅੰਦਰੋਂ ਪੌਜ਼ੀਟਿਵਿਟੀ ਦਿੰਦੀ ਹੈ ਬਹੁਤ ਹੀ ਜ਼ਿਆਦਾ

ਮੈਨੂੰ ਲੱਗਦਾ ਕਿ ਬੰਦਾ ਆਪਦੀ ਜ਼ਿੰਦਗੀ ਦੀ ਬਹੁਤ ਸਾਰੀਆਂ ਅਸਲੀਅਤ ਤੋਂ ਜਾਣੂ ਹੋ ਜਾਂਦਾ ਥੈਂਕ ਯੂ